ਇੱਕ ਸਤੰਬਰ ਉੱਨੀ ਸੌ ਨੱਬੇ ਪੰਜ ਫਰਵਰੀ ਦੋ ਹਜ਼ਾਰ ਤਿੰਨ ਦੋ ਮਾਰਚ ਉੱਨੀ ਸੌ ਨੜਿਨਵੇਂ ਇੱਕ ਜਨਵਰੀ ਦੋ ਹਜ਼ਾਰ ਦਸ ਸੌਲ੍ਹਾਂ ਸਤੰਬਰ ਦੋ ਹਜ਼ਾਰ ਸੌਲ੍ਹਾਂ